ਅਗਰ ਗੱਲ ਕੀਤੀ ਜਾਵੇ ਕੁਛ ਅਜਿਹੇ ਪੌਦਿਆਂ ਦੀ ਜਿਹੜੇ ਕਿ ਖੁੱਲੇ ਵਾਤਾਵਰਣ ਵਿੱਚ ਲਗਾਉਣੇ ਮੁਸ਼ਕਿਲ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਆ ਕਈ ਵਾਰ ਤਾਂ ਅਗਰ ਉਹਨਾਂ ਨੂੰ ਅਸੀਂ ਖੁੱਲ੍ਹੇ ਵਾਤਾਵਰਣ ਵਿੱਚ ਜਾਂ ਸਿੱਧਾ ਹੀ ਮਤਲਬ ਕਿ ਖੇਤ ਵਿੱਚ ਲਗਾ ਦਿੱਤਾ ਜਾਵੇ ਤਾਂ ਉਹਨਾਂ ਦਾ ਬਚਣਾ ਮੁਸ਼ਕਿਲ ਵੀ ਹੋ ਜਾਂਦਾ ਹੈ ਅਤੇ ਉਸ ਪੌਦੇ ਵਿੱਚ ਇੱਕ ਜਿਹੜਾ ਮੇਨ ਪੌਦਾ ਹੈ ਟਮਾਟਰ ਦਾ ਪੌਦਾ ਮਤਲਬ ਕਿ ਜੋ ਟਮਾਟਰ ਦੀ ਖੇਤੀ ਹੈ ਅਗਰ ਉਸਨੂੰ ਅਸੀਂ ਡਾਇਰੈਕਟ ਖੇਤ ਵਿੱਚ ਇੱਦਾਂ ਹੀ ਲਗਾ ਦਿੱਤਾ ਜਾਵੇ ਉਸ ਦੀ ਦੇਖਭਾਲ ਪ੍ਰੋਪਰ ਨਾ ਕੀਤੀ ਜਾਵੇ ਤਾਂ ਉਸ ਨਾਲ ਜੋ ਟਮਾਟਰ ਦਾ ਜੋ ਪੌਦਾ ਹੈ ਉਸਦਾ ਬਚਣਾ ਮੁਸ਼ਕਿਲ ਹੋ ਜਾਂਦਾ ਹੈ ਜ਼ਿਆਦਾ ਤੌਰ 'ਤੇ ਜੋ ਟਮਾਟਰ ਦਾ ਪੌਦਾ ਹੈ ਉਹ ਪੋਲੀ ਹਾਊਸ ਵਿੱਚ ਲਗਾਇਆ ਜਾਂਦਾ ਹੈ ਜਿਸ ਵਿੱਚ ਉਹਨੂੰ ਕਿ ਪ੍ਰੋਪਰ ਉਹਨੂੰ ਪੋਲੀ ਹਾਊਸ ਅੰਦਰੋਂ ਉਹਨੂੰ ਉੱਦਾਂ ਦਾ ਇਨਵਾਇਰਮੈਂਟ ਦਿੱਤਾ ਜਾਂਦਾ ਹੈ ਜਿਸ ਵਿੱਚੋਂ ਪੂਰੇ ਤਰੀਕੇ ਨਾਲ ਹੋ ਸਕੇ ਉਸਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ ਪੋਲੀ ਹਾਊਸ ਵਿੱਚ ਟਮਾਟਰ ਲਗਾਉਣ ਦਾ ਫਾਇਦਾ ਮੇਨ ਇਹ ਹੁੰਦਾ ਹੈ ਕਿ ਪੋਲੀ ਹਾਊਸ ਦੇ ਅੰਦਰ ਜੋ ਵੀ ਸਿੱਧਾ ਵਾਤਾਵਰਨ ਹੈ ਮਤਲਬ ਕਿ ਜੋ ਵੀ ਵਾਤਾਵਰਨ ਦਾ ਪ੍ਰਭਾਵ ਪੈਂਦਾ ਹੈ ਪੌਦੇ 'ਤੇ ਜਿੱਦਾਂ ਸੂਰਜ ਦੀ ਸਿੱਧੀ ਜੋ ਰੋਸ਼ਨੀ ਹੈ ਪੌਦੇ 'ਤੇ ਅਗਰ ਪਵੇ ਜ਼ਿਆਦਾ ਟਾਈਮ ਤਾਂ ਉਸ ਨਾਲ ਵੀ ਜੋ ਪੌਦਾ ਹੈ ਖ਼ਰਾਬ ਹੋ ਜਾਂਦਾ ਹੈ ਜਿਸ ਟਾਈਮ ਅਸੀਂ ਟਮਾਟਰ ਨੂੰ ਲਗਾਉਂਦੇ ਹਾਂ ਉਸ ਟਾਈਮ ਜਦੋਂ ਉਸਦੀ ਜਰਮੀਨੇਸ਼ਨ ਹੁੰਦੀ ਹੈ ਉਸ ਟਮਾਟਰ ਦੇ ਪੌਦੇ ਦੀ ਤਾਂ ਉਸ ਵਿੱਚ ਇੱਕ ਜਰਮੀਨੇਸ਼ਨ ਦੇ ਦੌਰਾਨ ਹੀ ਉਸ ਵਿੱਚ ਇੱਕ ਬਿਮਾਰੀ ਲੱਗ ਜਾਂਦੀ ਹੈ ਡੈਂਪਿੰਗ ਔਫ ਡੈਂਪਿੰਗ ਔਫ ਇੱਕ ਅਜਿਹੀ ਬਿਮਾਰੀ ਹੈ ਜੋ ਕਿ ਸੂਰਜ ਦੀ ਸਿੱਧੀ ਰੋਸ਼ਨੀ ਨਾਲ ਹੁੰਦੀ ਹੈ ਮਤਲਬ ਕਿ ਜ਼ਿਆਦਾਤਰ ਅਗਰ ਉਸ ਸੂਰਜ ਦੀ ਰੋਸ਼ਨੀ ਉਸ ਪੌਦੇ 'ਤੇ ਪਵੇ ਤਾਂ ਜੋ ਸੂਰਜ ਅ ਜੋ ਪੌਦਾ ਹੈ ਟਮਾਟਰ ਦਾ ਪੌਦਾ ਹੈ ਉਹ ਡਿੱਗਣਾ ਸ਼ੁਰੂ ਕਰ ਦਿੰਦਾ ਹੈ ਇਸ ਕਾਰਨ ਇਸ ਨੂੰ ਜ਼ਿਆਦਾਤਰ ਇਸਦੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਟਮਾਟਰ ਦੇ ਪੌਦੇ ਦੀ ਅਗਰ ਇਸ ਨੂੰ ਅਸੀਂ ਪੋਲੀ ਹਾਊਸ ਜਾਂ ਗਰੀਨ ਹਾਊਸ ਵਿੱਚ ਜਾਂ ਪ੍ਰੋਟੈਕਟਿਡ ਕਲਟੀਵੇਸ਼ਨ ਅੰਡਰ ਅੰਦਰ ਅਸੀਂ ਲਗਾਇਆ ਲਗਾਉਂਦੇ ਹਾਂ ਉਸਨੂੰ ਪੂਰੀ ਦੇਖਭਾਲ ਕਰਦੇ ਹਾਂ ਤਾਂ ਜੋ ਟਮਾਟਰ ਦਾ ਪੌਦਾ ਹੈ ਉਸਦੀ ਜੋ ਉਪਯੋਗ ਉਸਦੀ ਜੋ ਜੋ ਵੀ ਉਸਦੀ ਉਪਭੋਗਤਾ ਹੈ ਜਾਂ ਉਹ ਵਧੀਆ ਤਰੀਕੇ ਨਾਲ ਮਿਲਦੀ ਹੈ ਤਾਂ ਉਸਦੀ ਦੇਖਭਾਲ ਕਰਨ ਨਾਲ ਜੋ ਟਮਾਟਰ ਦਾ ਪੌਦਾ ਹੈ ਵਧੀਆ ਉੱਗਦਾ ਹੈ ਅਤੇ ਅਗਰ ਅਸੀਂ ਉਸਨੂੰ ਦੇਖ ਪੋਲੀ ਹਾਊਸ ਜਾਂ ਗਰੀਨ ਹਾਊਸ ਵਿੱਚ ਲਗਾਉਂਦੇ ਹਾਂ ਤਾਂ ਉਸਦੀ ਜੋ ਪੈਦਾਵਾਰ ਹੈ ਉਹ ਵਧੀਆ ਤਰੀਕੇ ਨਾਲ ਹੁੰਦੀ ਹੈ